ਹਾਂਜੀ ਜੇ ਰਨਿੰਗ ਦੀ ਗੱਲ ਕੀਤੀ ਜਾਵੇ ਤਾਂ ਮੇਰਾ ਟੈਂਨਥ ਤੋਂ ਲੈ ਕੇ ਗ੍ਰੈਜੂਏਸ਼ਨ ਤੱਕ ਹੁਣ ਤੱਕ ਮੇਰਾ ਡੇਲੀ ਦਾ ਹੀ ਗਰਾਉਂਡ ਦੇ ਵਿੱਚ ਜਾਂਦਾ ਅਤੇ ਡੇਲੀ ਹੀ ਮੈਂ ਰਨਿੰਗ ਕਰਦਾ ਅਤੇ ਰਨਿੰਗ ਕਰਨ ਦੇ ਨਾਲ ਮੇਰੇ ਸਰੀਰ ਦੇ ਵਿੱਚ ਫਲੈਕਸੀਬਿਲਟੀ ਰਹਿੰਦੀ ਆ ਜੋ ਵੇਟ ਆ ਉਹ ਕੰਟਰੋਲ 'ਚ ਰਹਿੰਦਾ ਸਰੀਰ ਸਾਰੇ ਦਾ ਸਾਰਾ ਸਿਹਤਮੰਦ ਰਹਿੰਦਾ ਗਾ ਅਤੇ ਸਾਰੇ ਦੇ ਸਾਰੇ ਸਰੀਰ ਦੀ ਵਧੀਆ ਐਕਸਰਸਾਈਜ਼ ਹੋ ਜਾਂਦੀ ਆ ਅਤੇ ਮੈਂ ਜਦੋਂ ਰਨਿੰਗ ਕਰਦੇ ਹੁੰਦੇ ਸੀ ਮੇਰਾ ਕਾਲਜ ਦੇ ਵਿੱਚ ਜੋ ਚਾਰ ਸੌ ਮੀਟਰ ਦੀਆਂ ਹੁੰਦੀਆਂ ਜਾਂ ਸੋਲਾਂ ਸੌ ਮੀਟਰ ਦੀ ਹੁੰਦੀ ਹੈਗੀ ਰਨਿੰਗ ਉਹਦੇ ਵਿੱਚ ਮੈਂ ਫਸਟ ਪੁਜ਼ੀਸ਼ਨ ਵੀ ਆਈ ਸੀ ਮੇਰੀ ਅਤੇ ਇਹਦੇ ਨਾਲ ਮੇਰਾ ਸਰੀਰ ਬਹੁਤ ਵਧੀਆ ਫਲੈਕਸੀਬਲ ਰਹਿੰਦਾ ਹੈਗਾ ਅਤੇ ਰਨਿੰਗ ਕਰਨ ਦੇ ਨਾਲ ਰਨਿੰਗ ਕਰਨ ਦੇ ਨਾਲ ਮੈਨੂੰ ਇੱਕ ਅਲੱਗ ਹੀ ਤਰ੍ਹਾਂ ਦਾ ਸਕੂਨ ਮਿਲਦਾ ਗਾ ਅਤੇ ਮੈਂ ਬਹੁਤ ਟਾਈਮ ਤੋਂ ਰਨਿੰਗ ਕਰਦਾ ਆ ਰਿਹਾ ਮੈਂ ਕਈ ਵਾਰ ਸਵੇਰੇ ਵੀ ਜਾਂਦਾ ਹੁੰਦਾ ਕਈ ਵਾਰੀ ਸ਼ਾਮ ਨੂੰ ਜਾਂਦਾ ਰਨਿੰਗ ਕਰਨ ਲਈ ਗਰਾਉਂਡ 'ਤੇ ਅਤੇ ਰਨਿੰਗ ਕਰਨ ਲਈ ਮੈਂ ਜ਼ਿਆਦਾਤਰ ਕੱਚੀ ਜਗ੍ਹਾਂ ਨੂੰ ਪ੍ਰੈਫਰ ਕਰਦਾ ਗਾ ਅਤੇ ਸਾਡੇ ਇੱਥੇ ਘਰ ਦੇ ਕੋਲ ਗਰਾਉਂਡ ਹੈਗਾ ਅਤੇ ਉੱਥੇ ਕੱਚੀ ਜਗ੍ਹਾ 'ਤੇ ਇੱਕ ਬਹੁਤ ਵਧੀਆ ਟਰੈਕ ਬਣਿਆ ਹੋਇਆ ਹੈਗਾ ਗਰਾਊਂਡ ਆ ਅਤੇ ਉੱਥੇ ਰਨਿੰਗ ਕਰਦਾ ਉਹਤੋਂ ਬਾਅਦ ਐਕਸਸਾਈਜ਼ ਹੁੰਦੀਆਂ ਪਰ ਸਭ ਤੋਂ ਪਹਿਲਾਂ ਵਾਰਮ ਅੱਪ ਕਰੀਦਾ ਅਤੇ ਇਹਦੇ ਨਾਲ ਮੇਰਾ ਬਹੁਤ ਵਧੀਆ ਬਾਡੀ ਨੂੰ ਇੱਕ ਤਰ੍ਹਾਂ ਦਾ ਜਿੱਦਾਂ ਆਪਾਂ ਕਹਿ ਦਿੰਦੇ ਹਾਂ ਫਿਊਲ ਮਿਲਦਾ ਉਵੇਂ ਮੇਰੇ ਫਿਊਲ ਦੀ ਤਰਾਂ ਕੰਮ ਕਰਦੀ ਰਨਿੰਗ ਮੇਰੇ ਲਈ ਅਤੇ ਇਹ ਮੇਰਾ ਸ਼ੌਂਕ ਵੀ ਆ ਜੇ ਪਹਿਲਾਂ ਕਹਾਂ ਪਹਿਲਾਂ ਮੇਰਾ ਸ਼ੌਂਕ ਹੀ ਆ ਅਤੇ ਜਿਹਦੇ ਨਾਲ ਮੇਰੀ ਸਿਹਤ ਬਹੁਤ ਵਧੀਆ ਰਹਿੰਦੀ ਆ ਅਤੇ ਮੈਂ ਜਿਹੜਾ ਆਪਣਾ ਸ਼ਡਿਊਲ ਆ ਕਦੇ ਵੀ ਕਦੇ ਵੀ ਬਰੇਕ ਨਹੀਂ ਕੀਤਾ